ਸਕੂਲਾਂ ਦੇ ਵਿੱਚ ਵੈਸੇ ਤਾਂ ਬਹੁਤ ਸਾਰੇ ਵਜ਼ੀਫੇ ਲੱਗਦੇ ਹੁੰਦੇ ਸੀ ਜਿਵੇਂ ਸਕੋਲਰਸ਼ਿਪ ਵਗੈਰਾ ਹੋ ਗਈ ਜਾਂ ਸਿੱਖ ਮਨਿਓਰਟੀ ਵਗੈਰਾ ਅਲ ਵਾਲੇ ਹੁੰਦੇ ਹੈ ਉਹਦੀ ਸਕੋਲਰਸ਼ਿਪ ਹੁੰਦੀ ਹੈ ਅਤੇ ਮੈਨੂੰ ਤਾਂ ਕਦੀ ਇਸ ਚੀਜ਼ ਦਾ ਲਾਭ ਨਹੀਂ ਹੋਇਆ ਸਰਕਾਰਾਂ ਵੈਸੇ ਕਹਿੰਦੀਆਂ ਤਾਂ ਬਹੁਤ ਨੇ ਕਿ ਇਸ ਦਾ ਲਾਭ ਬੱਚਿਆਂ ਨੂੰ ਬਹੁਤ ਜ਼ਿਆਦਾ ਹੋਊਗਾ ਪਰ ਮੇਰੀ ਜ਼ਿੰਦਗੀ ਦੇ ਵਿੱਚ ਕਦੇ ਐਂਵੇ ਦਾ ਕੋਈ ਪਲ ਨਹੀਂ ਆਇਆ ਨਾ ਮੈਂ ਕਿਸੀ ਨੂੰ ਐਦਾਂ ਦੇਖਿਆ ਮੈਨੂੰ ਤਾਂ ਮੈਨੂੰ ਵੀ ਨਹੀਂ ਕਦੇ ਇਸ ਚੀਜ਼ ਦਾ ਲਾਭ ਹੋਇਆ